ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰੁਣ ਕੁਮਾਰ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਰਹਿਣ ਵਾਲਾ ਹਾਂ ਅੱਜ ਕਿ ਜਿਵੇਂ ਮੈਨੂੰ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਕੋਈ ਬੁਣਾਈ ਅਤੇ ਸਿਲਾਈ ਤਕਨੀਕਾਂ ਜਾਂ ਸ਼ੈਲੀਆਂ ਹਨ ਜੋ ਤੁਸੀਂ ਭਵਿੱਖ ਵਿੱਚ ਸਿੱਖਣਾ ਜਾਂ ਖੋਜਣਾ ਚਾਹੋਗੇ ਇਸ ਦੇ ਉੱਤਰ ਵਿੱਚ ਮੈਂ ਬਸ ਇੰਨਾਂ ਕਹਿਣਾ ਚਾਹੁੰਦਾ ਹਾਂ ਜੀ ਹਾਂ ਕੁਝ ਬੁਣਾਈ ਅਤੇ ਸਿਲਾਈ ਤਕਨੀਕਾਂ ਹਨ ਜੋ ਮੈਂ ਭਵਿੱਖ ਵਿੱਚ ਸਿੱਖਣਾ ਜਾਂ ਸਮਝਣਾ ਚਾਹੁੰਦਾ ਹਾਂ ਇਹ ਸਿੱਖਣ ਦਾ ਇਹਨਾਂ ਨੂੰ ਫਾਇਦਾ ਵੀ ਹੁੰਦਾ ਹੈ ਬੰਦੇ ਨੂੰ ਆਪਣੀ ਸਮਝ ਹੋ ਜਾਂਦੀ ਹੈ ਇਹਨਾਂ ਬਾਰੇ ਇਹਨਾਂ ਵਿੱਚ ਪਹਿਲੇ ਨੰਬਰ 'ਤੇ ਤਾਂ ਆਉਂਦੇ ਹੈ ਮੇਰੇ ਕਨਿਕ ਕੰਮ ਹੁਣ ਤੁਸੀਂ ਪੁੱਛੋਗੇ ਕਿ ਇਹ ਕੀ ਹੁੰਦਾ ਹੈ ਇਹਨਾਂ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਇਹ ਇੱਕ ਤਕਨੀਕ ਸਿਲਾਈ ਦੇ ਮਹੱਤਵਪੂਰਨ ਹਿੱਸੇ ਹੁੰਦੇ ਹੈ ਇਸ ਦੇ ਵਿੱਚ ਕੀ ਹੁੰਦਾ ਹੈ ਇਸ ਦੇ ਵਿੱਚ ਪੰਜਾਬੀ ਫੀਤੇ ਪੜਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਨਾ ਪਾਸਾ ਅਤੇ ਲਾਗੇ ਜੇ ਹੁੰਦੇ ਹੈ ਨਾ ਉਹ ਅਕਸਰ ਫੁਰਤੀ ਨਾਲ ਕੀਤਾ ਜਾਂਦਾ ਹੈ ਇਹ ਇਹ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਂ ਇਸਨੂੰ ਸਿੱਖਣ ਲ ਵਿੱਚ ਬਹੁਤ ਉਤਸੁਕ ਹਾਂ ਜੇ ਮੈਂ ਕਿਸੇ ਹੋਰ ਚੀਜ਼ ਦੀ ਗੱਲ ਕਰਾਂ ਤਾਂ ਇਸ ਵਿੱਚ ਆਉਂਦਾ ਹੈ ਕਲਾਪ ਕੰਮ ਇਸਦੇ ਬਾਰੇ ਜਾਣਕਾਰੀ ਮੈਨੂੰ ਮੇਰੀ ਮਾਤਾ ਜੀ ਤੋਂ ਪਤਾ ਚੱਲੀ ਹੈ ਇਸ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਇੱਕ ਵਰਤਮਾਨ ਤਕਨੀਕਾਂ ਸਿਲਾਈ ਹੈ ਇਹਨਾਂ ਵਿੱਚ ਹੁੰਦਾ ਹੈ ਕਿ ਜੋ ਇਹਨਾਂ ਨਾਲ ਗਾਹਕ ਦੀਆਂ ਖਾਸੀਆਂ ਅਤੇ ਮਰਜ਼ੀਆਂ ਬਣਾਉਣ ਦੀ ਮਦਦ ਕਰਦੇ ਹਨ ਇਹ ਵੀ ਇੱਕ ਬਹੁਤ ਦਿਲਚਸਪ ਕੰਮ ਹੈ ਉਸਨੂੰ ਸਿੱਖਣ ਦੇ ਵੀ ਮੈਂ ਬਹੁਤ ਉਤਸੁਕ ਹਾਂ ਮੈਂ ਚਾਹੁੰਦਾ ਹਾਂ ਕਿ ਭਵਿੱਖ ਵਿੱਚ ਮੈਂ ਇਸ ਨੂੰ ਸਿਖਲਾਈ ਕਿਤੋਂ ਲਵਾਂ ਮੇਰੇ ਕਈ ਮਿੱਤਰਾਂ ਨੇ ਵੀ ਮੈ ਇਸ ਬਾਰੇ ਪੁੱਛਿਆ ਉਹਨਾਂ ਦੀ ਵੀ ਦਿਲਚਸਪੀ ਇਸ ਵਿੱਚ ਹੈ ਮੈਂ ਆਪਣੀ ਮਾਤਾ ਜੀ ਨੂੰ ਪੁੱਛ ਕੇ ਇਸ ਨੂੰ ਸਿੱਖਣ ਦੇ ਵਿੱਚ ਆਪਣੀ ਉਤਸੁਕਤਾ ਹਾਜ਼ਰ ਕਰਾਂਗਾ ਅਤੇ ਭਵਿੱਖ ਵਿੱਚ ਇਸ ਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ